ਮੈਂ ਪੰਜਾਬ ਦਾ ਵਾਸੀ ਹਾਂ ਅਤੇ ਮੇਰੇ ਪੰਜਾਬ ਵਿੱਚ ਉੱਨ ਦੀ ਕਾਫੀ ਜ਼ਿਆਦਾ ਖੇਤੀ ਹੁੰਦੀ ਹੈ ਜਿਸ ਵਿੱਚ ਘਰੇਲੂ ਉੱਨ ਤੋਂ ਬਣੇ ਹੋਏ ਕੱਪੜੇ ਜਿੱਦਾਂ ਕਿ ਸਵੈਟਰ ਵਗੈਰਾ ਜਾਂ ਹੋਰ ਸੂਤੀ ਕੱਪੜੇ ਬਹੁਤ ਹੀ ਜ਼ਿਆਦਾ ਪਸੰਦ ਕਰਦਾ ਹਾਂ ਇਸ ਵਿੱਚ ਮੈਂ ਆਪਣੇ ਘਰਦਿਆਂ ਨੂੰ ਵੀ ਘਰਦੇ ਕੱਪੜੇ ਹੀ ਜ਼ਿਆਦਾ ਪ੍ਰੋਵਾਈਡ ਕਰਵਾਉਂਦਾ ਹਾਂ ਬਜ਼ਾਰ ਦੇ ਰੇਸ਼ਮੀ ਕੱਪੜੇ ਅਸੀਂ ਬਹੁਤ ਘੱਟ ਪਸੰਦ ਕਰਦੇ ਹਾਂ ਮੇਰੇ ਬੱਚਿਆਂ ਨੂੰ ਅਤੇ ਮੈਂ ਆਪਣੀ ਵਾਈਫ ਨੂੰ ਘਰ ਦੇ ਕੱਪੜੇ ਬੁਣੇ ਹੋਏ ਹੀ ਪਹਿਨਾਉਂਦਾ ਹਾਂ ਅਤੇ ਉਹ ਵੀ ਜ਼ਿਆਦਾ ਉਹੀ ਪਸੰਦ ਕਰਦੇ ਹਨ ਖਾਸ ਤੌਰ 'ਤੇ ਸਰਦੀਆਂ ਨੂੰ ਸਵੈਟਰ ਵਗੈਰਾ ਜਾਂ ਗਰਮ ਉੱਨੀ ਕੱਪੜਿਆਂ ਦਾ ਅਸੀਂ ਬਹੁਤ ਹੀ ਜ਼ਿਆਦਾ ਵਰਤੋਂ ਕਰਦੇ ਹਾਂ ਬਜ਼ਾਰ ਨਾਲੋਂ ਇੱਕ ਤਾਂ ਸਾਨੂੰ ਸਸਤੇ ਪੈਂਦੇ ਹਨ ਅਤੇ ਨਾਲ ਉਹਨਾਂ ਦੇ ਜ਼ਿਆਦਾ ਟਾਈਮ ਤੱਕ ਖਰਾਬ ਨਹੀ ਹੁੰਦੇ ਹਨ ਬਰਦਮਾਨ ਬਰਦਾਨ ਕੰਪਨੀ ਜਿਹੜੀ ਹੈ ਉਹ ਉੱਨ ਦੀ ਕਾਫੀ ਅੱਛੀ ਕੰਪਨੀ ਹੈ ਅਤੇ ਅਸੀ ਉਹ ਕਾਫੀ ਜ਼ਿਆਦਾ ਯੂਜ਼ ਕਰਦੇ ਹਾਂ ਬਾਕੀ ਘਰ ਦੀ ਬੁਣਾਈ ਅਤੇ ਘਰ ਦੇ ਬੁਣੇ ਹੋਏ ਕੱਪੜਿਆਂ ਵਿੱਚ ਮਾਂ ਪਿਓ ਦਾਦੀ ਦਾ ਪੁਰਾਣੇ ਬਜ਼ੁਰਗਾਂ ਦਾ ਕਾਫੀ ਜ਼ਿਆਦਾ ਪਿਆਰ ਹੁੰਦਾ ਹੈ ਅਤੇ ਉਹ ਬੜੇ ਪਿਆਰ ਨਾਲ ਖਰੋਸ਼ੀਆ ਲਾ ਕੇ ਬੁਣਦੇ ਹਨ ਮੈਂ ਇਹੀ ਚਾਹੁੰਦਾ ਹਾਂ ਕਿ ਜ਼ਿਆਦਾਤਰ ਸਾਨੂੰ ਆਪਣੇ ਪੁਰਾਤਨ ਸਮੇਂ ਦੇ ਅਨੁਸਾਰ ਪੁਰਾਣੇ ਕੱਪੜੇ ਹੀ ਘਰ ਦੇ ਸ ਖੁਦ ਦੇ ਕੱਪੜੇ ਪਾਉਣੇ ਚਾਹੀਦੇ ਹਨ